ਪੱਚੀ ਮਾਰਚ ਉੱਨੀ ਸੌ ਛਿਆਸੀ ਪੱਚੀ ਜੁਲਾਈ ਉੱਨੀ ਸੌ ਅੱਸੀ ਤੀਹ ਅਗਸਤ ਉੱਨੀ ਸੌ ਪਚਾਨਵੇਂ ਦਸ ਨਵੰਬਰ ਦੋ ਹਜ਼ਾਰ ਬਾਰ੍ਹਾਂ ਅਠਾਰ੍ਹਾਂ ਜੂਨ ਦੋ ਹਜ਼ਾਰ ਅਠਾਰ੍ਹਾਂ